ਹੈਲੋ ਹੈਲੋ ਗੁਰਪਿੰ ਗੁਰਪਿੰਦਰ ਕੌਰ ਬੋਲਦੇ ਹੋ ਜੀ ਮੈਂ ਤੁਹਾਡੇ ਕੋਲੋਂ ਥੋੜ੍ਹੀ ਜਿਹੀ ਜਾਣਕਾਰੀ ਲੈਣੀ ਸੀ ਮੈਨੂੰ ਤੁਸੀਂ ਦੱਸ ਸਕਦੇ ਹੋ ਕਿ ਜਿਹੜੇ ਬੋਲੀਵੁੱਡ ਮਤਲਬ ਪੰਜਾਬ ਦੇ ਕਈ ਕਲਾਕਾਰ ਨੇ ਜਿਹੜੇ ਬਾਲੀਵੁੱਡ ਵਿੱਚ ਕੰਮ ਕਰਦੇ ਨੇ ਉਹਨਾਂ ਬਾਰੇ ਥੋੜ੍ਹੀ ਜਾਣਕਾਰੀ ਦੇ ਸਕਦੇ ਹੋ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹਾਂਜੀ ਹਾਂਜੀ ਠੀਕ ਹੈ ਜੀ

ਠੀਕ ਆ ਹਾਂਜੀ ਠੀਕ ਹੈ ਹਾਂਜੀ ਮੈਂ ਨਾ ਤੁਹਾਡੀ ਜਾਣਕਾਰੀ ਤੋਂ ਬਹੁਤ ਸੰਤੁਸ਼ਟ ਹੈ ਠੀਕ